ਮੇਰੀ ਮਨਪਸੰਦ ਕਿਤਾਬ ਨਾਨਕ ਸਿੰਘ ਦੀ ਪਵਿੱਤਰ ਪਾਪੀ ਹੈ ਇਹ ਬਹੁਤ ਹੀ ਵਧੀਆ ਨਾਵਲ ਹੈ ਇਸ ਨਾਵਲ 'ਤੇ ਬੋਲੀਵੁੱਡ ਵਿੱਚ ਇੱਕ ਮੂਵੀ ਵੀ ਬਣ ਚੁੱਕੀ ਹੈ ਇਹ ਬਹੁਤ ਹੀ ਪ੍ਰਸਿੱਧ ਨਾਵਲ ਮੰਨਿਆ ਗਿਆ ਹੈ ਜੋ ਕਿ ਨਾਨਕ ਸਿੰਘ ਦੁਆਰਾ ਲਿਖਿਆ ਗਿਆ ਹੈ ਮੈਂ ਇਸਨੂੰ ਖਰੀਦਣ ਲਈ ਦਿੱਲੀ ਗਈ ਜੋ ਕਿ ਮੈਨੂੰ ਬਹੁਤ ਹੀ ਪੁਰਾਣੀ ਕਿਤਾਬਾਂ ਦੀ ਦੁਕਾਨ 'ਚੋਂ ਮਿਲੀ ਮੈਨੂੰ ਇਸਨੂੰ ਖਰੀਦਣ ਲਈ ਬਹੁਤ ਦੂਰ ਜਾਣਾ ਪਿਆ ਅਤੇ ਬਹੁਤ ਹੀ ਕੋਸ਼ਿਸ਼ ਕਰਨੀ ਪਈ ਜਿਸ ਕਾਰਨ ਮੈਨੂੰ ਇਹ ਬਹੁਤ ਹੀ ਮੁਸ਼ਕਲ ਨਾਲ ਮਿਲੀ